ਹਾਂਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਬਸ ਵਧੀਆ ਘਰ ਵਿਆਹ ਰੱਖਿਆ ਹੋਇਆ ਬਸ ਹੁਣ ਉਹਦੀ ਸ਼ੋਪਿੰਗ ਚਲਦੀ ਪਈ ਆ ਹੋਰ ਕੀ ਹੁਣ ਤਾਂ ਰੋਜ਼ ਵੀ ਗੇੜੇ 'ਤੇ ਗੇੜਾ ਕਦੀ ਜਲੰਧਰ ਕਦੇ ਅੰਮ੍ਰਿਤਸਰ ਕਦੇ ਕਪੂਰਥਲਾ ਹਾਂ ਹਾਂ ਤੁਹਾਡੇ ਕਪੂਰਥਲੇ ਦਾ ਹਾਲ ਮੈਂ ਕੱਲ੍ਹ ਦੇਖਿਆ ਬੜਾ ਹੀ ਟਰੈਫਿਕ ਹੁੰਦਾ ਆਪਣੇ ਕਪੂਰਥਲੇ 'ਚ ਬੜੀ ਟਰੈਫਿਕ ਹੋਣ ਲੱਗ ਪਈ ਹੈ ਇੱਕ ਆਹ ਰਿਹੜੀਆਂ ਵਾਲੇ ਜਿਹੜੇ ਉਹਨਾਂ ਨੇ ਦੁਕਾਨਾਂ ਦੇ ਅੱਗੇ ਰਿਹੜੀਆਂ ਲਾਈਆਂ ਬਾਜ਼ਾਰ ਦੇ ਵਿੱਚ ਕੱਲ੍ਹ ਅਸੀਂ ਗਏ ਬਾਜ਼ਾਰ ਅੱਧਾ ਪੌਣਾ ਘੰਟਾ ਲਾ ਲਓ ਰਸਤੇ 'ਚ ਹੀ ਫਸੇ ਰਹੇ ਜਿਉਂ ਉੱਥੇ ਰਸਤੇ 'ਚ ਕੂੜੇ ਵਾਲਾ ਟਰੱਕ ਖੜ੍ਹਾ ਸੀ ਉਹਨੇ ਪਤਾ ਨਹੀਂ ਪਹਿਲਾਂ ਪੂਰਾ ਫੁੱਲ ਲੋਡ ਕੀਤਾ ਫਿਰ ਸਾਈਡ ਕੀਤਾ ਫਿਰ ਲੰਘਦੇ ਲੰਘਦੇ ਉਹਨੇ ਘੰਟਾ ਹੀ ਲਗਾ ਦਿੱਤਾ ਪੂਰਾ ਕਿਤੇ ਬਲੋਕੇਜ ਹੈ ਤਾਂ ਉੱਥੇ ਹਾਂਜੀ ਕਿੱਥੇ ਕੱਪੜਿਆਂ ਦੀ ਸ਼ੋਪਿੰਗ ਜਾਈ ਦਾ ਤਾਂ ਸੋਚ ਕੇ ਕਿ ਚਲੋ ਅੱਜ ਹੋ ਜਾਏਗੀ ਬਟ ਨਾ ਟਾਈਮ ਹੀ ਬੜਾ ਲੱਗ ਜਾਂਦਾ

ਉਹੀ ਹੈ ਨਾ ਸ਼ਹਿਰ ਆਪਣਾ ਛੋਟਾ ਜਿਹਾ ਅਤੇ ਬਟ ਟਰੈਫਿਕ ਇੰਨਾ ਕੋਈ ਹਿਸਾਬ ਨਹੀਂ ਹੁਣ ਹਰ ਇੱਕ ਨਿੱਕੇ ਨਿੱਕੇ ਨਿਆਣੇ ਨੇ ਤਾਂ ਸਕੂਟੀ ਚੱਕੀ ਹੋਈ ਹੈ ਛੋਟੇ ਛੋਟੇ ਬੱਚੇ ਸਕੂਟੀ ਲਈ ਫਿਰਦੇ ਆ ਟਿਊਸ਼ਨ ਸਕੂਟੀ 'ਤੇ ਜਾ ਰਹੇ ਆ ਸਕੂਲ ਵੀ ਸਕੂਟੀ 'ਤੇ ਜਾ ਰਹੇ ਹੈ ਉਹੀ ਹੈ ਨਾ ਪਹਿਲਾਂ ਤਾਂ ਉਹ ਲੱਭੇ ਕਿ ਹੈ ਕਿਹਦੀ ਹੈ ਅੱਜ ਕਾਹਲੀ ਕਾਹਲੀ 'ਚ ਕਿਸੇ ਨੇ ਮਾਰ ਮੂਰ ਦਿੱਤੀ ਗੱਡੀ ਪਿੱਛੋਂ ਤਾਂ ਪੰਗਾ ਤਾਂ ਉੱਥੇ ਚੀਕ ਚਿਹਾੜਾ ਪਾ ਕੇ ਬਹਿ ਜਾਂਦੇ ਲੋਕ

ਉਹੀ ਨਾ ਬੜਾ ਔਖਾ ਲੋਕਾਂ ਦਾ ਕੀ ਕਰੀਏ ਉਹੀ ਹੈ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਸਕੂਟੀਆਂ ਨਾ ਦੇਣ ਹੋਰ ਵੱਡਿਆਂ ਨੇ ਤਾਂ ਚਲੋ ਕੰਮ ਕਾਰ 'ਤੇ ਜਾਣਾ ਹੀ ਹੈ ਹੋਰ ਇੰਨੇ ਐਕਸੀਡੈਂਟ ਹੋ ਰਹੇ ਆ ਬੱਚਿਆਂ ਦੀ ਲਾਪਰਵਾਹੀਆਂ ਕਰਕੇ ਹੀ ਹੋ ਰਹੇ ਆ

ਉਹੀ ਹੈ ਨਾ ਜੇ ਰੂਲ ਦਾ ਪਤਾ ਨਹੀਂ ਉਹਨਾਂ ਨੂੰ ਟਰੈਫਿਕ ਦਾ ਅੱਗੇ ਪਿੱਛੇ ਸਿੱਧੀ ਪੁੱਠੀ ਜਿੱਥੇ ਆਏ ਵਾੜੀ ਜਾਂਦੇ ਆ

ਰੀਸੋ ਰੀਸ ਉਹਨੇ ਲੈ ਆਉਂਦੀ ਅਤੇ ਚਲੋ ਜੀ ਮੈਂ ਵੀ ਲੈ ਚੱਲਾਂ ਚਲੋ ਚਲੋ ਠੀਕ ਹੈ